ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਹਾਂ ਅਤੇ ਮੈਨੂੰ ਆਪਣੇ ਉੱਤੇ ਬੜਾ ਹੀ ਮਾਣ ਹੈ ਕਿ ਮੈਂ ਅੰਮ੍ਰਿਤਸਰ ਵਿੱਚ ਰਹਿਦੀ ਹਾਂ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ ਦੇ ਉੱਤੇ ਬੜੇ ਹੀ ਜ਼ਿਆਦਾ ਇਤਿਹਾਸਿਕ ਸਥਾਨ ਅਤੇ ਹੋਰ ਕਈ ਮਹੱਤਵਪੂਰਨ ਚੀਜ਼ਾਂ ਹਨ ਜੋ ਕਿ ਦੇਖਣ ਲਾਇਕ ਹਨ ਲੋਕ ਇਸ ਨੂੰ ਦੂਰ ਦੂਰ ਤੋਂ ਦੇਖਣ ਆਉਂਦੇ ਹਨ ਜਿਸ ਤਰ੍ਹਾਂ ਕਿ ਮੈਂ ਆਪਣੇ ਅੰਮ੍ਰਿਤਸਰ ਵਿੱਚ ਮਸ਼ਹੂਰ ਇਤਿਹਾਸਿਕ ਸਥਾਨ ਦੀ ਗੱਲ ਕਰਾਂ ਜੋ ਕਿ ਹਰਿਮੰਦਰ ਸਾਹਿਬ ਹੈ ਲੋਕ ਇਸ ਅ ਹਰਿਮੰਦਰ ਸਾਹਿਬ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਆਉਂਦੇ ਹਨ ਅਤੇ ਬੜਾ ਆਪਣਾ ਸ ਸਮਾਂ ਬਿਤਾਉਣ ਵਾਸਤੇ ਸਮਾਂ ਕੱਢ ਕੇ ਆਉਂਦੇ ਹਨ ਅਤੇ ਇੱਥੇ ਆ ਕੇ ਬਾਬਾ ਜੀ ਦੇ ਦਰਸ਼ਨ ਕਰਦੇ ਹਨ ਇਹ ਬਹੁਤ ਹੀ ਵਧੀਆ ਜਗ੍ਹਾ ਹੈ ਅਤੇ ਜਿੱਥੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅੰਮ੍ਰਿਤਸਰ ਵਿੱਚ ਕਈ ਥਾਵਾਂ ਹਨ ਜਿੱਥੇ ਸਾਨੂੰ ਘੁੰਮ ਕੇ ਬੜਾ ਹੀ ਵਧੀਆ ਲੱਗਦਾ ਹੈ ਇਹ ਤਾਂ ਮੈਂ ਇਤਿਹਾਸਿਕ ਥਾਂ ਦੀ ਗੱਲ ਕੀਤੀ ਸੀਗੀ ਜਿਸ ਤਰ੍ਹਾਂ ਹੁਣ ਅੰਮ੍ਰਿਤਸਰ ਵਿੱਚ ਕਈ ਕਿਲ੍ਹੇ ਵੀ ਹਨ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਕਈ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਅੰਮ੍ਰਿਤਸਰ ਵਿੱਚ ਕਈ ਥਾਵਾਂ ਹਨ ਜੋ ਕਿ ਗਿਣਤੀ ਵਿੱਚ ਵੀ ਨਹੀਂ ਹਨ ਇੰਨੀਆਂ ਥਾਵਾਂ ਸਾਡੇ ਘੁੰਮਣ ਵਿੱਚ ਆਉਂਦੀਆਂ ਹਨ ਸਾਨੂੰ ਆਪਣਾ ਸਮਾਂ ਕੱਢ ਕੇ ਅੰਮ੍ਰਿਤਸਰ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ ਅਤੇ ਇਹਨਾਂ ਚੀਜ਼ਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਤੇ ਘੁੰਮਣਾ ਚਾਹੀਦਾ ਹੈ ਧੰਨਵਾਦ